ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਜੋਤ ਕੌਰ ਹੈ ਮੈਨੇ ਤੁਹਾਡੀ ਏਜੰਸੀ ਵੱਲੋਂ ਇੱਕ ਕੈਬ ਬੁੱਕ ਕੀਤੀ ਸੀ ਜੋ ਕਿ ਮੈਨੇ ਚੰਡੀਗੜ੍ਹ ਜਾਣ ਲਈ ਕਰੀ ਸੀ ਅਤੇ ਮੈਂ ਜਦੋਂ ਸਵੇਰੇ ਅੱਠ ਵਜੇ ਰਾਗੋਮਾਜਰੇ 'ਤੇ ਪਹੁੰਚ ਗਈ ਮੈਨੇ ਉਸ ਕੈਬ ਨੂੰ ਵੀ ਉੱਥੇ ਹੀ ਆਉਣ ਲਈ ਬੁੱਕ ਕੀਤਾ ਸੀ ਪਰ ਉੱਥੇ ਕੈਬ ਨਹੀਂ ਆਈ ਜਦੋਂ ਕਿ ਸਵੇਰ ਦੇ ਹੁਣ ਸਾਢੇ ਨੌ ਵੱਜ ਚੁੱਕੇ ਸਨ ਪਰ ਕੈਬ ਉਦੋਂ ਵੀ ਉੱਥੇ ਨਹੀਂ ਪਹੁੰਚੀ ਮੈਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਮੈਨੇ ਤਾਂ ਕੈਬ ਪਹਿਲਾਂ ਹੀ ਬੁੱਕ ਕਰ ਦਿੱਤੀ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੀ ਕੈਬ ਲੇਟ ਆਉਣ ਕਾਰਨ ਮੈਨੇ ਅਪਣਾ ਜਾਣਾ ਵੀ ਕੈਂਸਲ ਕਰ ਦਿੱਤਾ ਇਸ ਲਈ ਮੈਂ ਤੁਹਾਡੀ ਕੈਬ ਨੂੰ ਕੈਂਸਲ ਕਰਨਾ ਚਾਹੁੰਦੀ ਹਾਂ ਮੈਨੇ ਤੁਹਾਨੂੰ ਇਸ ਦੀ ਪੇਮੇਂਟ ਵੀ ਪਹਿਲਾਂ ਕਰ ਦਿੱਤੀ ਸੀ ਇਸ ਲਈ ਮੇਰੀ ਪੇਮੈਂਟ ਰਿਫੰਡ ਕੀਤੀ ਜਾਵੇ ਤੁਹਾਡੇ ਨਾਲ ਮੇਰਾ ਐਕਸਪੀਰੀਅੰਸ ਬਹੁਤ ਖ਼ਰਾਬ ਰਿਹਾ ਇਸ ਵਾਰ ਦਾ ਜੇਕਰ ਮੈਨੂੰ ਅੱਗੇ ਕਰਨੀ ਹੋਏਗੀ ਕੈਬ ਬੁੱਕ ਤਾਂ ਮੈਂ ਤੁਹਾਡੇ ਵੱਲੋਂ ਕੈਬ ਬੁੱਕ ਕਰਵਾ ਲਵਾਂਗੀ